ਹਾਂਜੀ ਕੌਣ ਹਾਂਜੀ ਕਿੱਥੋਂ ਅੱਛਾ ਜੀ ਅੱਛਾ ਮਤਲਬ ਕਿ ਅੱਛਾ ਜੀ ਫੂਡ ਕਿਹੜੇ ਕਿਹੜੇ ਮਸ਼ਹੂਰ ਹੈ ਹੈਲੋ ਹਾਂਜੀ ਹਾਂਜੀ ਜ਼ਰੂਰ ਜਿੱਦਾਂ ਕਿ ਤੁਹਾਨੂੰ ਪਤਾ ਆ ਪੰਜਾਬ ਬਹੁਤ ਵਧੀਆ ਕੰਟ ਬਹੁਤ ਵਧੀਆ ਸ਼ਹਿਰ ਆ ਹੈ ਨਾ ਪੰਜਾਬ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਸ਼ਹਿਰ ਹੁੰਦੇ ਆ ਅਤੇ ਅਲੱਗ ਅਲੱਗ ਤਰੀਕਿਆਂ ਦੇ ਫੂਡਸ ਫੂਡਸ ਬਣਦੇ ਆ ਅਲੱਗ ਅਲੱਗ ਤਰ੍ਹਾਂ ਦੇ ਖਾਣਾ ਹੁੰਦਾ ਆ ਕਿ ਵੱਖੋ ਵੱਖਰੀ ਸਿਟੀ ਦਾ ਕੋਈ ਵੱਖੋ ਵੱਖਰਾ ਆਪਣਾ ਆਪਣਾ ਖਾਣਾ ਹੁੰਦਾ ਆ ਕਿ ਜਿੱਦਾਂ ਕਿ ਤੁਹਾਨੂੰ ਥੋੜ੍ਹਾ ਬਹੁਤ ਪਤਾ ਹੋਣਾ ਪੰਜਾਬ ਬਾਰੇ ਜਿੱਦਾਂ ਕਿ ਸਭ ਤੋਂ ਅੱਛਾ ਜੀ ਯੂਟਿਊਬ 'ਤੇ ਵੀ ਜਿੱਦਾਂ ਕਿ ਅੰਮ੍ਰਿਤਸਰ ਦੇ ਜਿੱਦਾਂ ਕਿ ਅਲੱਗ ਅਲੱਗ ਸ਼ਹਿਰ ਦੇ ਵਿੱਚ ਅਲੱਗ ਅਲੱਗ ਫੂਡ ਹੁੰਦੇ ਆ ਅਤੇ ਉੱਦਾਂ ਹੀ ਪਟਿਆਲੇ ਜਿੱਦਾਂ ਕਿ ਪਟਿਆ ਅੰਮ੍ਰਿਤਸਰ ਦੇ ਵਿੱਚ ਕੁਲਚੇ ਛੋਲੇ ਫੇਮਸ ਬਹੁਤ ਹੁੰਦੇ ਆ ਹਾਂਜੀ ਜਿੱਦਾਂ ਕਿ ਪੰਜਾਬ ਦੇ ਵਿੱਚ ਜੋ ਜ਼ਿਆਦਾ ਫੇਮਸ ਹੁੰਦੇ ਆ ਮੱਕੀ ਦੀ ਰੋਟੀ ਹੋ ਗਈ ਸਰ੍ਹੋਂ ਦਾ ਸਾਗ ਹੋ ਗਿਆ ਲੱਸੀ ਹੋ ਗਈ ਮੱਖਣ ਹੋ ਗਿਆ ਜੋ ਪੰਜਾਬ ਦਾ ਸਭ ਤੋਂ ਫੇਮਸ ਖਾਣਾ ਮੰਨਿਆ ਜਾਂਦਾ ਆ

ਇਸ ਤੋਂ ਇਲਾਵਾ ਜਿਵੇਂ ਸਭ ਤੋਂ ਜ਼ਿਆਦਾ ਇੱਥੇ ਜੋ ਮੰਨਿਆ ਜਾਂਦਾ ਹੈ ਗੁੜ ਹੋ ਗਿਆ ਗੰਨੇ ਦਾ ਰਸ ਹੋ ਗਿਆ ਸ਼ੱਕਰ ਹੋ ਗਈ ਜੋ ਲੋਕ ਖਾ ਸਭ ਤੋਂ ਵੱਧ ਖਾਣੇ ਨਾਲ ਖਾਣਾ ਜ਼ਰੂਰ ਪਸੰਦ ਕਰਦੇ ਹੈ ਹਾਂਜੀ ਜਿੱਦਾਂ ਕੁਲਚੇ ਛੋਲੇ ਹੋ ਗਏ ਪੂਰੀਆਂ ਹੋ ਗਈਆਂ

ਹਾਂਜੀ ਫੇਮ ਹਾਂਜੀ ਫੇਮਸ ਪਲੇਸ ਜਿੱਦਾਂ ਕਿ ਅੰਮ੍ਰਿਤਸਰ ਹੈ ਗੋਲਡਨ ਟੈਂਪਲ ਹੋ ਗਿਆ ਪਟਿਆਲਾ ਹੋ ਗਿਆ ਆਪਣਾ ਲਾਲ ਕਿਲ੍ਹਾ ਉੱਧਰ ਹੋ ਗਿਆ ਰੈਡ ਫੋਟ ਹੋ ਗਿਆ ਹਾਂਜੀ ਉਹ ਘੁੰਮਣ ਫਿਰਨ ਦੇ ਟੂਰਿਸਟ ਪਲੇਸ ਵੀ ਹੈਗੀਆਂ ਨੇ ਇੱਥੇ ਦੇ ਟੂਰਿਸਟ ਪਲੇਸ ਦੇ ਨਾਲ ਨਾਲ ਹੀ ਅਤੇ ਇੱਥੇ ਵਧੀਆ ਤਰੀਕੇ ਦਾ ਫੂਡ ਵੀ ਮਿਲਦਾ ਜਿੱਦਾਂ ਦਾ ਤੁਸੀਂ ਪੂਰੇ ਚਾਹੋਗੇ ਉੱਦਾਂ ਤੁਹਾਨੂੰ ਫੂਡ ਮਿਲ ਜਾਏਗਾ ਤੁਹਾਡਾ ਯੂਟਿਊਬ 'ਤੇ ਤੁਸੀਂ ਇਹਨੂੰ ਅਪਲੋਡ ਵੀ ਕਰ ਸਕਦੇ ਹੋ ਹਾਂਜੀ ਹਾਂ ਹਾਂਜੀ ਲੱਸੀ ਦਾ ਹਾਂਜੀ ਹਾਂਜੀ ਜਿੱਦਾਂ ਕਿ ਲੱਸੀ ਤੁਹਾਨੂੰ ਪਤਾ ਮੱਖਣ ਤੋਂ ਬਣਦੀ ਹੈ ਪਿਓਰ ਜੋ ਗਾਂ ਦਾ ਦੁੱਧ ਹੁੰਦਾ ਉਹਨੂੰ ਰਿੜਕਦੇ ਪੰਜਾਬ ਦੇ ਵਿੱਚ ਜੋ ਪੁਰਾਣੀ ਰੀਤ ਚੱਲਦੀ ਆ ਰਿਵਾਜ਼ ਹੁੰਦਾ ਆ ਉਹਨੂੰ ਰਿੜਕਣਾ ਦੁੱਧ ਤੋਂ ਲੱਸੀ ਬਣਾਉਣਾ ਲੱਸੀ ਤੋਂ ਫਿਰ ਮੱਖਣ ਬਣਾਉਣਾ ਅਤੇ ਉਹਨੂੰ ਰੋਟੀ ਜਾਂ ਸਾਗ ਦੇ ਨਾਲ ਪੀਤਾ ਜਾਂਦਾ ਜੋ ਫੇਮਸ ਇੱਕ ਡਰਿੰਕ ਵੀ ਹੁੰਦਾ ਆ ਇੱਕ ਟੇਸਟ ਵੀ ਹੁੰਦਾ ਆ ਹਾਂਜੀ ਇਹ ਸਭ ਤੋਂ ਪਹਿਲਾਂ ਤਾਂ ਪੁਰਾਤਨ ਸਮੇਂ ਤੋਂ ਚੱਲਣ ਵਾਲਾ ਇੱਕ ਡਰਿੰਕ ਹੈ ਹਾਂਜੀ ਹਾਂਜੀ ਹਾਂਜੀ ਸਰ੍ਹੋਂ ਦਾ ਸਾਗ ਹਾਂਜੀ ਜਿੱਦਾਂ ਕਿ ਸਰ੍ਹੋਂ ਦਾ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਮੱਖਣ ਹੋ ਗਿਆ ਇਹ ਪੰਜਾਬ ਦਾ ਵਿਰਾਸਤੀ ਫੂਡ ਹੈ ਭੋਜਨ ਹੈ ਜੋ ਆਪਾਂ ਪੁਰਾਣੇ ਸਮੇਂ ਤੋਂ ਖਾਂਦੇ ਆ ਰਹੇ ਅਤੇ ਹੁਣ ਵੀ ਪੰਜਾਬ 'ਚ ਬਹੁਤ ਫੇਮਸ ਆ ਇਹ ਲੋਕ ਆਪਣੇ ਘਰਾਂ ਦੇ ਵਿੱਚ ਬਣਾਉਣ ਖਾਣਾ ਬਹੁਤ ਪਸੰਦ ਕਰਦੇ ਨੇ ਅਤੇ ਬੜੇ ਚਾਅ ਨਾਲ ਖਾਂਦੇ ਨੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੋਸਟ ਵੈਲਕਮ ਜ਼ਰੂਰ ਵਿਜਿਟ ਕਰੋ ਓਕੇ